ਹੈਲੋ ਸਤਿ ਸ਼੍ਰੀ ਅਕਾਲ ਵੀਰੇ ਤੁਸੀਂ ਬਰਾ ਰੈਸਟੋਰੈਂਟ ਬੋਲਦੇ ਹੋ ਮੈਂ ਤੁਹਾਡੇ ਰੈਸਟੋਰੈਂਟ ਦੇ ਵਿੱਚ ਖਾਣਾ ਔਡਰ ਕਰਨਾ ਸੀਗਾ ਮੈਂ ਸੁਣਿਆ ਤੁਹਾਡੇ ਰੈਸਟੋਰੈਂਟ ਦੇ ਵਿੱਚ ਖਾਣਾ ਬਹੁਤ ਟੇਸਟੀ ਹੁੰਦਾ ਹੈਗਾ ਅਤੇ ਇਸ ਕਰਕੇ ਮੈਂ ਬਹੁਤ ਜ਼ਿਆਦਾ ਰਾਸ ਰੈਸਟ ਵੀ ਖਾਣਾ ਜਿਹੜਾ ਆਰਡਰ ਕਰਨਾ ਤੁਹਾਡੇ ਰੈਸਟੋਰੈਂਟ ਦੇ ਵਿੱਚ ਕੀ ਤੁਸੀਂ ਰੈਸਟੋਰੈਂਟ ਛੇਤੀ ਛੇਤੀ ਪਹੁੰਚਾ ਦਿਓਗੇ ਜਿਹੜਾ ਮੇਰਾ ਖਾਣਾ ਹੋਊਗਾ ਅਤੇ ਮੇਰੇ ਦੋਸਤਾਂ ਵਾਸਤੇ ਕਿਉਂਕਿ ਭੁੱਖ ਬਹੁਤ ਜ਼ਿਆਦਾ ਲੱਗੀ ਹੈਗੀ ਤਾਂ ਕਰਕੇ ਵੀ ਅੱਧੇ ਘੰਟੇ ਤੋਂ ਪਹਿਲਾਂ ਪਹਿਲਾਂ ਤੁਸੀਂ ਵੀ ਸਾਡੇ ਪਿੰਡ ਦੇ ਵਿੱਚ ਮੈਨੂੰ ਇਹ ਖਾਣਾ ਚਾਹੀਦਾ ਹੈਗਾ ਕਿਉਂਕਿ ਮੇਰੇ ਦੋਸਤ ਵੀ ਆਏ ਹੋਏ ਨੇ ਉਹਨਾਂ ਵਾਸਤੇ ਕੁਛ ਕੁ ਅਜਿਹੀਆਂ ਚੀਜ਼ਾਂ ਚਾਹੀਦੀਆਂ ਹਨ ਜੋ ਤੁਹਾਡੇ ਰੈਸਟੋਰੈਂਟ ਦੇ ਵਿੱਚ ਬਹੁਤ ਵਧੀਆ ਬਣਦੀਆਂ ਹਨ ਠੀਕ ਹੈ ਅਤੇ ਜਿਹੜੀ ਵੀ ਸਭ ਤੋਂ ਜ਼ਿਆਦਾ ਵਧੀਆ ਚੀਜ਼ ਹੈ ਮੈਂ ਸੁਣਿਆ ਤੁਹਾਡੇ ਇੱਥੇ ਬਰਗਰ ਪੀਜ਼ਾ ਬਹੁਤ ਵਧੀਆ ਬਣਦਾ ਹੈ ਜਿਸ ਕਰਕੇ ਮੈਂ ਤੁਹਾਨੂੰ ਬਰਗਰ ਪੀਜ਼ੇ ਦਾ ਮੋਮੋਜ ਦਾ ਠੀਕ ਹੈ ਜੀ ਔਡਰ ਦਿੰਦੀ ਹਾਂ ਕਿਉਂਕਿ ਮੇਰਾ ਔਡਰ ਹੈ ਅਤੇ ਮੈਨੂੰ ਇਹਦੇ ਵਿਚ ਡਿਸਕਾਉਟ ਵੀ ਚਾਹੀਦਾ ਹੈਗਾ ਡਿਸਕਾਉਟ ਮੈਨੂੰ ਦਿਓਗੇ ਤਾਂ ਮੈਨੂੰ ਜਲਦੀ ਤੋਂ ਜਲਦੀ ਤੁਹਾਡਾ ਬਰਗਰ ਅੱਠ ਬਰਗਰ ਚਾਰ ਪੀਜ਼ਾ ਮੈਨੂੰ ਚਾਹੀਦੇ ਹੈਗੇ ਤੁਸੀਂ ਪਿੰਡ ਝੁੰਬੇ ਦੇ ਵਿੱਚ ਪਿੰਡ ਝੁੰਬੇ ਦੇ ਵਿੱਚ ਤੁਸੀਂ ਵੀ ਇਹ ਪਹੁੰਚਾ ਸਕਦੇ ਹੋ ਤੁਸੀਂ ਸਕੂਲ ਦੇ ਕੋਲ ਪਹੁੰਚਾ ਦਿਓ ਅਸੀਂ ਉੱਥੋਂ ਲੈ ਜਾਵਾਂਗੇ ਐਡਰੈਸ ਤੁਹਾਨੂੰ ਮੈਂ ਪਿੰਡ ਝੁੰਬੇ ਦਾ ਦਿੰਦੀ ਹੈਗੀ ਅਤੇ